ਮੇਰੀ ਸਭ ਤੋਂ ਯਾਦਗਾਰੀ ਯਾਤਰਾ ਵੈਸ਼ਨੋ ਦੇਵੀ ਜੰਮੂ ਕਟੜਾ ਦੀ ਹੈ ਇਹ ਮੈਂ ਪਿਛਲੇ ਸਾਲ ਦਸੰਬਰ ਵਿੱਚ ਆਪਣੇ ਕੋਲਜ ਦੇ ਦੋਸਤਾਂ ਨਾਲ ਇਸ ਯਾਤਰਾ ਵਿੱਚ ਸ਼ਾਮਿਲ ਹੋਇਆ ਇਹ ਯਾਤਰਾ ਮੈਂ ਜਲੰਧਰ ਵਿ ਤੋਂ ਸ਼ੁਰੂ ਕੀਤੀ ਰਾਤ ਨੂੰ ਸਾਢੇ ਗਿਆਰਾਂ ਵਜੇ ਸਾਡੀ ਟ੍ਰੇਨ ਸੀ ਇਹ ਟਰੇਨ ਵਿੱਚ ਆਪਾਂ ਬੈਠ ਕੇ ਸਫਰ ਸ਼ੁਰੂ ਕੀਤਾ ਟਰੇਨ ਵਿੱਚ ਆਪਾਂ ਬਹੁਤ ਮੌਜ ਮਸਤੀਆਂ ਕੀਤੀ ਅਤੇ ਖਾਣਾ ਪੀਣਾ ਖਾਂਦੇ ਹੋਏ ਆਪਾਂ ਜੰਮੂ ਕਟੜਾ ਪਹੁੰਚ ਗਏ ਉਥੇ ਪਹੁੰਚ ਕੇ ਅਸੀਂ ਥੋੜ੍ਹਾ ਵਿਸ਼ਰਾਮ ਕੀਤਾ ਅਤੇ ਆਪਾਂ ਚੜ੍ਹਾਈ ਲਈ ਚਲੇ ਗਏ ਚੜ੍ਹਾਈ ਚੌਦਾਂ ਕਿਲੋਮੀਟਰ ਦੇ ਲਗਭਗ ਸੀ ਆਪਾਂ ਚੜ੍ਹਾਈ ਕਰਦੇ ਕਰਦੇ ਮਾਤਾ ਦਾ ਨਾਮ ਲੈਂਦੇ ਲੈਂਦੇ ਖਾਂਦੇ ਪੀਂਦੇ ਮੌਜ ਮਸਤੀ ਕਰਦੇ ਹੋਏ ਚੜ੍ਹਾਈ ਕਰਦੇ ਗਏ ਅਤੇ ਵਿੱਚ ਵਿੱਚ ਆਪਾਂ ਬਹੁਤ ਥਕਾਵਟ ਹੋਣ ਕਰਕੇ ਆਪਾਂ ਰੁਕਦੇ ਵੀ ਰਹੇ ਵਿੱਚ ਆਪਾਂ ਰੈਸਟ ਵੀ ਲਿਤੀ ਅਤੇ ਥੋੜ੍ਹੀ ਦੇਰ ਬਾਅਦ ਆਪਾਂ ਖਾਣਾ ਪੀਣਾ ਖਾ ਕੇ ਫਿਰ ਤੋਂ ਆਪਾਂ ਚੜ੍ਹਾਈ ਸ਼ੁਰੂ ਕੀਤੀ ਇੰਨੇ ਵਿੱਚ ਆਪਾਂ ਅਰਧ ਕੁਆਰੀ ਉੱਥੇ ਇੱਕ ਜਗ੍ਹਾ ਹੈ ਉੱਥੇ ਪਹੁੰਚ ਕੇ ਆਪਾਂ ਉੱਥੇ ਦੋ ਤਿੰਨ ਘੰਟੇ ਵਿਸ਼ਰਾਮ ਕੀਤਾ ਉਸ ਤੋਂ ਬਾਅਦ ਅਸੀਂ ਉੱਪਰ ਗ ਭਵਨ ਪਹੁੰਚ ਗਏ ਜਿੱਥੇ ਪਹੁੰਚ ਕੇ ਅਸੀਂ ਮਾਤਾ ਦੇ ਦਰਸ਼ਨ ਕੀਤੇ ਸਾਡਾ ਸੁਭਾਗ ਸੀ ਕਿ ਅਸੀਂ ਉਸ ਟਾਈਮ ਪਹੁੰਚੇ ਜਿਸ ਟਾਈਮ ਮਾਤਾ ਦੀ ਪ੍ਰਾਚੀਨ ਗੁਫਾ ਖੁੱਲ੍ਹੀ ਸੀ ਅਤੇ ਆਪਾਂ ਮਾ ਉਸ ਗੁਫਾ ਵਿੱਚ ਦਰਸ਼ਨ ਕੀਤੇ ਜਿਸ ਨੂੰ ਦਰਸ਼ਨ ਕਰਕੇ ਅਸੀਂ ਬਹੁਤ ਹੀ ਖੁਸ਼ ਹੋ ਗਏ ਅਤੇ ਸਾਡੇ ਧੰਨ ਭਾਗ ਹੋਏ ਅਤੇ ਉਸ ਤੋਂ ਬਾਅਦ ਅਸੀਂ ਦਰਸ਼ਨ ਕਰਕੇ ਵਾਪਸ ਆਏ ਅਤੇ ਇਸ ਤਰ੍ਹਾਂ ਸਾਡੀ ਯਾਤਰਾ ਸਫਲ ਹੋਈ ਇਹ ਇਹ ਮੇਰੀ ਸਭ ਤੋਂ ਯਾਦਗਾਰੀ ਯਾਤਰਾ ਸੀ